ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਕੰਪਨੀ ਤੋਂ ਬਹੁਤ ਜ਼ਿਆਦਾ ਪ੍ਰੋਡਕਟ ਔਨਲਾਈਨ ਖਰੀਦਦਾ ਹਾਂ ਜੋ ਕਿ ਮੈਨੂੰ ਬਹੁਤ ਪਸੰਦ ਹੈ ਹੁਣ ਕੁਝ ਮਹੀਨੇ ਤੋਂ ਪ੍ਰੋਡਕਟ ਬਿਲਕੁਲ ਵੀ ਵਧੀਆ ਨਹੀਂ ਆ ਰਹੇ ਅਤੇ ਨਾ ਹੀ ਪ੍ਰੋਡਕਟ ਵਧੀਆ ਹਨ ਅਤੇ ਨਾ ਹੀ ਉਹਨਾਂ ਦੀ ਸਰਵਿਸ ਇਹ ਤੁਹਾਨੂੰ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਹੁਣ ਕੁਛ ਦਿਨ ਪਹਿਲਾਂ ਮੈਂ ਇੱਕ ਚਾਕੂ ਦਾ ਸੈੱਟ ਖਰੀਦਿਆ ਸੀ ਉਹ ਬਿਲਕੁਲ ਵੀ ਵਧੀਆ ਨਹੀਂ ਆਇਆ ਇਸ ਨਾਲ ਮੈਨੂੰ ਤੁਹਾਡੀ ਸਰਵਿਸ ਵੀ ਖਰਾਬ ਲੱਗੀ ਅਤੇ ਉਸਦੀ ਪੈਕਿੰਗ ਵੀ ਬਹੁਤ ਹੀ ਖਰਾਬ ਸੀ ਉਸ ਨਾਲ ਕਿਸੇ ਵੀ ਨੂੰ ਵੀ ਚੋਟ ਲੱਗ ਸਕਦੀ ਸੀ ਉਸ 'ਤੇ ਕਿਸੇ ਦਾ ਵੀ ਹੱਥ ਲੱਗਣ ਨਾਲ ਹੱਥ ਕੱਟ ਸਕਦਾ ਸੀ ਇਹ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਿਆ ਫਿਰ ਉੱਤੋਂ ਉਸਦੀ ਡਿਲੀਵਰੀ ਵੀ ਲੇਟ ਸੀ ਮੈਪ ਵਿੱਚ ਤਾਂ ਡਿਲੀਵਰੀ ਸੋਲ਼ਾਂ ਤਰੀਕ ਦੀ ਦਿਖਾਈ ਜਾ ਰਹੀ ਸੀ ਪਰ ਜੋ ਜੋ ਕਿ ਲੇਟ ਹੋ ਕੇ ਮੈਨੂੰ ਪਾਰਸਲ ਵੀਹ ਤਰੀਕ ਨੂੰ ਰਸੀਵ ਹੋਇਆ ਇਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਮੈਂ ਤੁਹਾਡੀ ਕੰਪਨੀ ਤੋਂ ਪ੍ਰੋਡਕਟ ਖਰੀਦਣੇ ਬੰਦ ਕਰ ਦੇਣੇ ਹਨ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੀ ਸ਼ਿਕਾਇਤ ਦਾ ਧਿਆਨ ਰੱਖੋਗੇ ਅਤੇ ਆਪਣੀ ਸਰਵਿਸ ਨੂੰ ਬਹੁਤ ਹੀ ਵਧੀਆ ਕਰੋਗੇ ਅਤੇ ਇਸ ਦਾ ਧਿਆਨ ਅੱਗੇ ਤੋਂ ਰੱਖੋਗੇ ਕਿ ਤੁਹਾਡੇ ਕਿਸੇ ਵੀ ਕਸਟਮਰ ਨੂੰ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਤੁਸੀਂ ਇਸ ਪ੍ਰੋਡਕਟ ਨੂੰ ਮੈਂ ਤੁਹਾਨੂੰ ਵਾਪਸ ਕਰ ਰਿਹਾ ਹਾਂ ਜਿਸ ਨਾਲ ਕਿ ਤੁਸੀਂ ਮੈਨੂੰ ਵਧੀਆ ਡਿਲੀਵਰੀ ਨਾਲ ਅਤੇ ਵਧੀਆ ਪ੍ਰੋਡਕਟ ਭੇਜ ਕੇ ਮੈਨੂੰ ਖੁਸ਼ ਕਰ ਸਕੋ ਆਪ ਦਾ ਬਹੁਤ ਬਹੁਤ ਧੰਨਵਾਦ